ਮੇਰੇ ਖੇਤਰ ਦੇ ਵਿੱਚ ਔਰਤਾਂ ਦੀ ਸਮੇਂ ਸਮੇਂ ਦੇ ਨਾਲ ਜਿਹੜੀ ਭੂਮਿਕਾ ਹੈ ਉਹ ਬਹੁਤ ਹੀ ਬਦਲ ਗਈ ਹੈ ਕਿਉਂਕਿ ਔਰਤਾਂ ਸਾਡੇ ਇਲਾਕੇ ਦੇ ਵਿੱਚ ਅੱਜ ਕੱਲ੍ਹ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਲੈ ਰਹੀਆਂ ਹਨ ਜ਼ਿਆਦਾ ਪੜ੍ਹ ਰਹੀਆਂ ਹਨ ਲੜਕੀਆਂ ਖਾਸ ਕਰਕੇ ਅੱਜ ਕੱਲ੍ਹ ਪੜ੍ਹਾਈ ਦੇ ਵਿੱਚ ਬਹੁਤ ਹੀ ਅੱਗੇ ਲੜਕਿਆਂ ਤੋਂ ਵੀ ਅੱਗੇ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਔਰਤਾਂ ਅੱਜ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਨੌਕਰੀ ਪੇਸ਼ਾ ਵੀ ਹਨ ਨੌਕਰੀ ਕਰਨ ਵਾਸਤੇ ਆਪਣੇ ਘਰੋਂ ਦੂਰ ਦੁਰਾਡੇ ਦੇ ਇਲਾਕਿਆਂ ਵੱਲ ਵੀ ਜਾਂਦੀਆਂ ਹਨ ਅਤੇ ਰੋਜ਼ਾਨਾ ਇਸ ਤਰ੍ਹਾਂ ਉਹ ਆਪਣੇ ਘਰ ਦਾ ਅਤੇ ਆਪਣਾ ਗੁਜ਼ਾਰਾ ਬਹੁਤ ਹੀ ਅੱਛੇ ਤਰੀਕੇ ਨਾਲ ਕਰ ਸਕਦੀਆਂ ਹਨ ਪੜ੍ਹਾਈ ਦੇ ਨਾਲ ਕਈ ਮੌਕੇ ਔਰਤਾਂ ਵਾਸਤੇ ਖੁੱਲ੍ਹੇ ਹਨ ਅਤੇ ਔਰਤਾਂ ਦਾ ਜੀਵਨ ਪੱਧਰ ਬਹੁਤ ਹੀ ਜ਼ਿਆਦਾ ਉੱਚਾ ਹੋਇਆ ਹੈ ਪਰ ਇਸ ਦੇ ਨਾਲ ਨਾਲ ਕਈ ਰੁਕਾਵਟਾਂ ਦਾ ਸਾਹਮਣਾ ਵੀ ਔਰਤਾਂ ਨੂੰ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦੇ ਜਿਹੜਾ ਪਰਿਵਾਰ ਗ੍ਰਹਿਸਥ ਦੇ ਵਿੱਚ ਉਹ ਵਿਚਰਦੀਆਂ ਹਨ ਉਹਨਾਂ ਦੇ ਬੱਚਿਆਂ ਨੂੰ ਸਾਂਭਣਾ ਸੰਭਾਲਣਾ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਸੰਭਾਲਣਾ ਔਰਤਾਂ ਨੂੰ ਉਸ ਚੀਜ਼ ਨੂੰ ਆਪਸ ਦੇ ਵਿੱਚ ਤਾਲਮੇਲ ਕਾਇਮ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤਾਂ ਆਉਂਦੀਆਂ ਹਨ ਪਰ ਉਹ ਫਿਰ ਵੀ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਰੋਕ ਸ ਸਮਝਦਾਰੀ ਨਾਲ ਸੰਭਾਲ ਰਹੀਆਂ ਹਨ ਇਸ ਦੇ ਨਾਲ ਨਾਲ ਹੋਰ ਵੀ ਕਈ ਔਕੜਾਂ ਹਨ ਜਿਵੇਂ ਆਉਣ ਜਾਣ ਦੇ ਦੌਰਾਨ ਦਿੱਕਤਾਂ ਇਹ ਪਰੇਸ਼ਾਨੀਆਂ ਉਹਨਾਂ ਨੂੰ ਆਉਂਦੀਆਂ ਹਨ ਪਰ ਇਸ ਦੇ ਨਾਲ ਨਾਲ ਫਿਰ ਵੀ ਉਹ ਆਪਣੇ ਆਪ ਨੂੰ ਸਾਂਭ ਸੰਭਾਲ ਕਰਕੇ ਬਹੁਤ ਅੱਗੇ ਵੱਧ ਚੁੱਕੀਆਂ ਹਨ